ਇੱਕ ਵਾਰ ਮੇਰੇ ਫੋਨ ਦੇ ਉੱਤੇ ਕੋਲ ਆਈ ਦੋ ਵਾਰ ਤਿੰਨ ਵਾਰ ਚਾਰ ਵਾਰ ਕੋਲ ਆਈ ਜਦੋਂ ਮੈਂ ਫੋਨ ਚੱਕਿਆ ਤਾਂ ਉਹ ਬੰਦਾ ਮੈਨੂੰ ਕਹਿ ਰਿਹਾ ਕਿ ਤੁਹਾਡੇ ਫੋਨ ਦੇ ਉੱਪਰ ਓ ਟੀ ਪੀ ਆ ਰਿਹਾ ਤੁਸੀਂ ਮੈਨੂੰ ਓ ਟੀ ਪੀ ਦ ਦਵੋ ਔਰ ਮੈਂ ਉਹਨੂੰ ਕਿਹਾ ਕਿ ਓ ਟੀ ਪੀ ਤੁਹਾਨੂੰ ਕਿਉਂ ਦੇਵਾਂ ਉਹ ਬੋਲਦਾ ਕਿ ਓ ਟੀ ਪੀ ਦਿਓ ਜਿਹੜਾ ਤੁਹਾਡੇ ਬੈਂਕ ਦੇ ਵਿੱਚ ਬੈਲੇਂਸ ਹੈ ਨਹੀਂ ਤਾਂ ਉਹ ਸਾਰਾ ਸਾਫ ਕਰ ਦਿੱਤਾ ਜਾਵੇਗਾ ਨਵੇਂ ਸਿਰੇ ਤੋਂ ਜੋ ਤੁਹਾਡੀ ਸੈਲਰੀ ਆਏਗੀ ਉਹ ਤੁਹਾਨੂੰ ਤੁਹਾਡੀ ਤਨਖਾਹ ਆਏਗੀ ਉਹ ਤੁਹਾਨੂੰ ਤਾਂ ਹੀ ਪਏਗੀ ਅਗਰ ਤੁਸੀਂ ਓ ਟੀ ਪੀ ਮੈਨੂੰ ਦਵੋਗੇ ਮੈਂ ਤੁਹਾਡੀ ਕੰਪਨੀ ਜਿਹੜੀ ਆਊਟਸੋਰਸ ਕੰਪਨੀ ਥਰੂ ਤੁਸੀਂ ਕੰਮ ਕਰ ਰਹੇ ਹੋ ਉਸ ਕੰਪਨੀ ਦਾ ਮੈਨੇਜਰ ਗੱਲ ਕਰ ਰਿਹਾ ਕੌਣ ਮੈਨੇਜਰ ਗੱਲ ਕਰ ਰਿਹਾ ਅਤੇ ਮੈਂ ਉਹ ਓ ਟੀ ਪੀ ਨਾਲ ਦੇ ਬੈਂਕ ਤੋਂ ਜਾ ਕੇ ਪਤਾ ਕਰਿਆ ਕਿ ਆਪਾਂ ਇੱਦਾਂ ਕਿਸੇ ਨੂੰ ਓ ਟੀ ਪੀ ਦੇ ਸਕਦੇ ਹਾਂ ਉਨ੍ਹਾਂ ਨੇ ਮੈਨੂੰ ਉਸੇ ਟਾਈਮ ਮਨ੍ਹਾ ਕੀਤਾ ਕਿ ਓ ਟੀ ਪੀ ਕਦੇ ਵੀ ਕਿਸੇ ਦੇ ਨਾਲ ਤੁਸੀਂ ਸ਼ੇਅਰ ਨਹੀਂ ਕਰਨਾ ਅਗਰ ਤੁਸੀਂ ਓ ਟੀ ਪੀ ਸ਼ੇਅਰ ਕਰੋਗੇ ਤਾਂ ਤੁਹਾਡੇ ਬੈਂਕ ਦਾ ਬੈਲੇਂਸ ਹੈ ਉਹ ਜਿਹੜੇ ਫਰੋਡ ਲੋਕ ਹੁੰਦੇ ਆ ਉਹ ਤੁਹਾਡਾ ਖਾਤਾ ਸਾਫ ਕਰ ਦੇਣਗੇ ਔਰ ਇਹ ਮੈਨੂੰ ਬੈਂਕ 'ਚ ਜਾ ਕੇ ਪਤਾ ਲੱਗਿਆ ਔਰ ਮੈਂ ਦੁਬਾਰਾ ਕਦੇ ਵੀ ਕਿਸੇ ਨਾਲ ਓ ਟੀ ਪੀ ਸ਼ੇਅਰ ਕਰ ਨਹੀਂ ਸਕਦਾ